ਸਾਡੇ ਖੇਤਰ ਵਿੱਚ ਮੌਨਸੂਨ ਸੀਜ਼ਨ ਜਿਹੜਾ ਹੈਗਾ ਉਹ ਜੁਲਾਈ ਅਗਸਤ ਤੋਂ ਸ਼ੁਰੂ ਹੁੰਦਾ ਹੈ ਕਿਉਂਕਿ ਅਸੀਂ ਸਾਡਾ ਜਿਹੜਾ ਖੇਤਰੀ ਏਰੀਆ ਪੈਂਦਾ ਹੈ ਉੱਤਰੀ ਭਾਰਤ ਪੈ ਜਾਂਦਾ ਹੈ ਅਤੇ ਇਹ ਜੁਲਾਈ ਅਗਸਤ 'ਚ ਮੌਨਸੂਨ ਸ਼ੁਰੂ ਹੁੰਦਾ ਹੈ ਅਤੇ ਇਹਦੀ ਇਹ ਜਿਹੜੀ ਮਾਤਰਾ ਹੁੰਦੀ ਹੈ ਮੌਨਸੂਨ ਦੀ ਉਸ ਸ਼ੁਰੂਆਤ ਦੇ ਵਿੱਚ ਕਾਫੀ ਜ਼ਿਆਦਾ ਹੁੰਦੀ ਹੈ ਕਿਉਂਕਿ ਜਿਹੜਾ ਮੌਨਸੂਨ ਇਹ ਹੁੰਦਾ ਹੈ ਇਹ ਬਿਲਕੁਲ ਹੀ ਜਿਹੜਾ ਦਕਸ਼ੀਨ ਪੱਛਚਿਮ ਜਿਹੜੀਆਂ ਪਵਨਾ ਹੁੰਦੀਆਂ ਹਨ ਉਹਦੇ ਕਰਕੇ ਮੌਨਸੂਨ ਸੀਜ਼ਨ ਸ਼ੁਰੂ ਹੁੰਦਾ ਹੈ ਅਤੇ ਇਹ 'ਚ ਜਿਹੜੀ ਵਰਖਾ ਦੀ ਮਾਤਰਾ ਹੈ ਉਹ ਮੱਧਮ ਹੀ ਹੁੰਦੀ ਹੈ ਅਤੇ ਇਹ ਸਾਡੇ ਜੀਵਨ ਨੂੰ ਕਾਫੀ ਪ੍ਰਭਾਵਿਤ ਕਰਦੀ ਹੈ ਅਤੇ ਜਿਹੜਾ ਇਹ ਮੌਨਸੂਨ ਇਹ ਵਰਖਾ ਹੁੰਦੀ ਹੈ ਕਈ ਫ਼ਸਲਾਂ ਵਾਸਤੇ ਬਹੁਤ ਲਾਭਕਾਰੀ ਹੁੰਦੀ ਹੈ ਅਤੇ ਕਿਸਾਨਾਂ ਨੂੰ ਇਸ ਵਰਖਾ ਦਾ ਕਾਫੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਕਿਉਂਕਿ ਇਹਦੇ ਨਾਲ ਉਨ੍ਹਾਂ ਦੇ ਖੇਤਾਂ ਉਹਨਾਂ ਦੇ ਖੇਤਾਂ ਨੂੰ ਚੰਗੀ ਤਰ੍ਹਾਂ ਸਿੰਚਾਈ ਹੋ ਜਾਂਦੀ ਹੈ ਅਤੇ ਇੱਕ ਚੰਗੀ ਵਰਖਾ ਦਾ ਜਿਹੜਾ ਪੱਧਰ ਹੁੰਦਾ ਹੈ ਉਹ ਸਾਡੇ ਧਰਤੀ ਦੇ ਜਿਹੜਾ ਅੰਡਰਗਰਾਊਂਡ ਜਿਹੜਾ ਅ ਬੋਤਲ ਦਾ ਜਿਹੜਾ ਪਾਣੀ ਹੁੰਦਾ ਹੈ ਉਹਦੇ ਲੈਵਲ ਨੂੰ ਵੀ ਵਧਾਉਂਦਾ ਹੈ ਇਸ ਕਰਕੇ ਵਰਖਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੇ ਖੇਤਰ ਵਿੱਚ ਜਿਹੜੀ ਵਰਖਾ ਦੀ ਮਾਤਰਾ ਹੁੰਦੀ ਹੈ ਉਹ ਜਨਜੀਵਨ ਨੂੰ ਕਾਫੀ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਅਗਰ ਵਰਖਾ ਲੋੜ ਤੋਂ ਵੱਧ ਹੁੰਦੀ ਹੈ ਤਾਂ ਕਈ ਤਰ੍ਹਾਂ ਦੀਆਂ ਮ ਜਗ੍ਹਾ 'ਤੇ ਪਾਣੀ ਇਕੱਠਾ ਹੋ ਜਾਂਦਾ ਹੈ ਅਤੇ ਕਈ ਜਗ੍ਹਾ 'ਤੇ ਬਾੜ ਵੀ ਆ ਜਾਂਦੀ ਹੈ ਅਤੇ ਕਈ ਪਾਣੀ ਇਕੱਠਾ ਹੋਣ ਦੇ ਕਰਕੇ ਕਈ ਬਿਮਾਰੀਆਂ ਵੀ ਫੈਲ ਜਾਂਦੀਆਂ ਹਨ ਅਤੇ ਇਸ ਕਰਕੇ ਪਾਣੀ ਵਰਖਾ ਦੀ ਲੋੜ ਵੀ ਹੁੰਦੀ ਹੈ ਇਹਦੀ ਜ਼ਰੂਰਤ ਵੀ ਹੁੰਦੀ ਹੈ ਤੇ ਇੱਕ ਜ਼ਰੂਰਤ ਤੋਂ ਜ਼ਿਆਦਾ ਅ ਜਿਹੜੀ ਜੇ ਵਰਖਾ ਹੁੰਦੀ ਹੈ ਤਾਂ ਇਹ ਸਾਡੇ ਜੀਵਨ ਨੂੰ ਅਸਤ ਵਿਅਸਤ ਵੀ ਕਰ ਦਿੰਦੀ ਹੈ